ਦੋ ਅਕਤੂਬਰ ਦੋ ਹਜ਼ਾਰ ਦਸ ਸੋਲ੍ਹਾਂ ਜਨਵਰੀ ਦੋ ਹਜ਼ਾਰ ਪੰਦਰਾਂ ਛੱਬੀ ਅਗਸਤ ਦੋ ਹਜ਼ਾਰ ਚੌਦਾਂ ਤਿੰਨ ਅਕਤੂਬਰ ਦੋ ਹਜ਼ਾਰ ਤੇਰ੍ਹਾਂ ਦੋ ਸਪਤੰਬਰ ਦੋ ਹਜ਼ਾਰ ਸੋਲ੍ਹਾਂ